ਪੰਜਾਬੀ ਭਾਰਤ ਦੀਆਂ ਬਾਈ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ ਪੰਜਾਬੀ ਭਾਸ਼ਾ ਨੂੰ ਦੁਨੀਆਂ ਭਰ ਵਿੱਚ ਸੌ ਮਿਲੀਅਨ ਤੋਂ ਵੱਧ ਲੋਕ ਬੋਲਦੇ ਹਨ ਵੱਡੇ ਪੰਜਾਬ ਵਿੱਚ ਲਗਭਗ ਨੱਬੇ ਮਿਲੀਅਨ ਇੱਕ ਇਲਾਕਾ ਜੋ ਸੰਨ ਉੱਨੀ ਸੌ ਸੰਤਾਲੀ ਦੀ ਵੰਡ ਦੌਰਾਨ ਬ੍ਰਿਟਿਸ਼ ਦੁਆਰਾ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ ਸੀ ਹੋਰ ਦਸ ਮਿਲੀਅਨ ਪੰਜਾਬੀ ਬੋਲਣ ਵਾਲੇ ਭਾਈਚਾਰੇ ਕਨੇਡਾ ਯੂਨਾਈਟਿਡ ਕਿੰਗਡਮ ਸੰਯੁਕਤ ਰਾਜ ਮਲੇਸ਼ੀਆ ਦੱਖਣੀ ਅਫਰੀਕਾ ਸੰਯੁਕਤ ਅਰਬ ਅਮੀਰਾਤ ਅਤੇ ਹੋਰ ਥਾਵਾਂ 'ਤੇ ਫੈਲੇ ਹੋਏ ਹਨ ਭਾਰਤ ਵਿੱਚ ਪੰਜਾਬ ਪੰਜਾਬੀ ਦੀਆਂ ਮੁੱਖ ਉਪ ਭਾਸ਼ਾਵਾਂ ਵਿੱਚ ਸ਼ਾਮਿਲ ਹਨ ਮਾਝੀ ਦੁਆਬੀ ਮਲਵਈ ਅਤੇ ਪੋਧਵੀ ਜਿਨ੍ਹਾਂ ਦਾ ਮੁੱਖ ਪੰਜਾਬੀ ਭਾਸ਼ਾ ਉੱਤੇ ਖੇਤਰੀ ਹਿੰਦੀ ਜਾਂ ਸੰਸਕ੍ਰਿਤ ਪ੍ਰਭਾਵ ਹੈ ਪਾਕਿਸਤਾਨ ਵਿੱਚ ਖੇਤਰੀ ਸਿੰਧੀ ਭਾਸ਼ਾ ਮੁੱਖ ਪੰਜਾਬੀ ਭਾਸ਼ਾ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਦੇ ਨਤੀਜੇ ਵੱਜੋਂ ਮਾਝੀ ਪੋਠੋੋਹਾਰੀ ਹਿੰਦਕੋ ਅਤੇ ਮੁਲਤਾਨੀ ਵਰਗੀਆਂ ਉੱਪ ਬੋਲ਼ੀਆਂ ਬਣ ਜਾਂਦੀਆਂ ਹਨ ਪਾਕਿਸਤਾਨੀ ਪੰਜਾਬੀ ਵਿੱਚ ਫਾਰਸੀ ਮੱਧ ਏਸ਼ੀਆ ਅਤੇ ਅਰਬੀ ਸ਼ਬਦਾਵਲੀ ਦਾ ਵੀ ਪ੍ਰਭਾਵ ਹੈ ਪੰਜਾਬੀ ਲਿਖਣ ਲਈ ਕੋਈ ਵੀ ਤਿੰਨ ਅੱਖਰਾਂ ਦੀ ਵਰਤੋਂ ਕਰ ਸਕਦਾ ਹੈ ਜਿਵੇਂ ਕਿ ਗੁਰਮੁਖੀ ਸ਼ਾਹਮੁਖੀ ਅਤੇ ਦੇਵਨਾਗਰੀ ਗੁਰਮੁਖੀ ਨਾਮ ਦਾ ਅਰਥ ਹੈ ਗੁਰੂ ਦੇ ਮੂੰਹ ਤੋਂ ਸ਼ਾਹਮੁਖੀ ਦਾ ਅਨੁਵਾਦ ਰਾਜੇ ਦੇ ਮੂੰਹ ਤੋਂ ਅਤੇ ਦੇਵਨਾਗਰੀ ਦਾ ਅਰਥ ਬ੍ਰਹਮ ਪ੍ਰਕਾਸ਼ ਦਾ